ਸਾਡੇ ਖੇਤਰ ਵਿੱਚ ਬਹੁਤ ਤਰ੍ਹਾਂ ਦੇ ਰਿਵਾਇਤੀ ਪਕਵਾਨ ਪਕਾਏ ਜਾਂਦੇ ਹਨ ਕਿਉਂਕਿ ਇੱਥੇ ਅਲੱਗ ਅਲੱਗ ਧਰਮ ਨਾਲ਼ ਸੰਬੰਧਿਤ ਲੋਕ ਰਹਿੰਦੇ ਹਨ ਇਹਨਾਂ ਦੇ ਆਪਣੇ ਰੀਤੀ ਰਿਵਾਜ ਅਤੇ ਰਿਵਾਇਤੀ ਪਕਵਾਨ ਹਨ ਅਸੀਂ ਜ਼ਿਆਦਾਤਰ ਰੁੱਤਾਂ ਦੇ ਹਿਸਾਬ ਨਾਲ਼ ਪਕਵਾਨ ਬਣਾਉਂਦੇ ਹਾਂ ਜਿਵੇਂ ਕਿ ਫੱਗਣ ਦੇ ਮਹੀਨੇ ਵਿੱਚ ਮਾਤਾ ਰਾਣੀ ਦਾ ਮੱਥਾ ਟੇਕਣ ਲਈ ਗੁਲਗੁਲੇ ਕਚੌਰੀਆਂ ਬਣਾਈਆਂ ਜਾਂਦੀਆਂ ਹਨ ਬਰਸਾਤ ਦੇ ਮੌਸਮ ਵਿੱਚ ਸਾਵਨ ਦੇ ਮਹੀਨੇ ਰੱਖੜੀਆਂ ਦੇ ਦਿਨ ਖੀਰ ਪੂੜੇ ਬਣਾਏ ਜਾਂਦੇ ਹਨ ਜੋ ਕਿ ਬਹੁਤ ਹੀ ਲੋਕ ਚਾਅ ਦੇ ਨਾਲ਼ ਖਾਂਦੇ ਹਨ ਅਤੇ ਬਰਸਾਤ ਦੇ ਮੌਸਮ ਵਿੱਚ ਛੋਲੇ ਪੂਰੀਆਂ ਆਦਿ ਬਣਾਈਆਂ ਜਾਂਦੀਆਂ ਹਨ ਅਤੇ ਬਰਸਾ ਸਿਆਲ ਦੇ ਮਹੀਨੇ ਵਿੱਚ ਆਮ ਤੌਰ 'ਤੇ ਲੋਕ ਕਈ ਤਰ੍ਹਾਂ ਦੇ ਪਰੌਂਠੇ ਬਣਾਉਂਦੇ ਹਨ ਜਿਵੇਂ ਕਿ ਆਲੂ ਵਾਲ਼ੇ ਮੂਲੀਆਂ ਵਾਲ਼ੇ ਬਹੁਤ ਤਰ੍ਹਾਂ ਤਰ੍ਹਾਂ ਦੇ ਪਕਵਾਨ ਆਦਿ ਬਣਾਏ ਜਾਂਦੇ ਹਨ